ਅੱਜ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਖਾਣਾ ਪਕਾਉਣ ਲਈ ਐਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਕੀ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਖਾਣਾ ਬਣਾਉਣ ਸਮੇਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੈਸ ਦਾ ਇਸਤੇਮਾਲ ਘੱਟ ਤੋਂ ਘੱਟ ਕੀਤਾ ਜਾਵੇ ਜਿਸ ਦੇ ਨਾਲ ਗੈਸ ਦੀ ਬੱਚਤ ਹੋਵੇਗੀ ਅਤੇ ਜਿਵੇਂ ਕਿ ਕਈ ਲੋਕ ਗਿੱਲੇ ਭਾਂਡੇ ਸਿੱਧੇ ਹੀ ਗੈਸ 'ਤੇ ਰੱਖ ਦਿੰਦੇ ਹਨ ਜਿਸ ਨਾਲ ਉਸ ਨੂੰ ਗਰਮ ਹੋਣ 'ਤੇ ਜ਼ਿਆਦਾ ਟਾਈਮ ਲੱਗਦਾ ਹੈ ਅਤੇ ਗੈਸ ਦੀ ਬਰਬਾਦੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਕਈ ਲੋਕ ਤਾਂ ਫਰਿਜ ਤੋਂ ਕੱਢ ਕੇ ਸਿੱਧੇ ਠੰਡੇ ਭਾਂਡੇ ਵੀ ਗੈਸ 'ਤੇ ਰੱਖ ਦਿੰਦੇ ਨੇ ਅਤੇ ਇਸ ਨਾਲ ਜਿਵੇਂ ਕਿ ਦੁੱਧ ਵਰਗੀਆਂ ਆਈਟਮਾਂ ਗਰਮ ਹੋਣ ਵਿੱਚ ਜਿਆਦਾ ਟਾਈਮ ਲਗਾਉਂਦੀਆਂ ਨੇ ਜਿਸ ਨਾਲ ਗੈਸ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ ਅਤੇ ਸਾਨੂੰ ਇੱਕ ਗੱਲ ਹੋਰ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਾਨੂੰ ਗੈਸ ਦੇ ਲਾਗੇ ਜ਼ਿਆਦਾ ਕੱਪੜੇ ਕੱਪੜਿਆਂ ਵਾਲੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜਿਸ ਕਾਰਨ ਅੱਗ ਲੱਗਣ ਦਾ ਖਤਰਾ ਬਣ ਸਕਦਾ ਹੈ ਅਤੇ ਉਸਦੇ ਨਾਲ ਸਾਨੂੰ ਟਾਈਮ 'ਤੇ ਟਾਈਮ ਸਾਨੂੰ ਗੈਸ ਦੀ ਸਫਾਈ ਕਰਨੀ ਚਾਹੀਦੀ ਹੈ ਜਿਵੇਂ ਕਿ ਐਲ ਪੀ ਜੀ ਸਲਿੰਡਰ ਨਾਲ ਜੁੜੀਆਂ ਪਾਈਪਾਂ ਦੀ ਉਸਦੇ ਨਟ ਕਸਣੇ ਚਾਹੀਦੇ ਹਨ ਅਤੇ ਜੇਕਰ ਸਾਨੂੰ ਲੱਗਦਾ ਹੈ ਕਿ ਗੈਸ ਦਾ ਰੰਗ ਬਦਲ ਰਿਹਾ ਹੈ ਤਾਂ ਇਸ ਦਾ ਮਤਲਬ ਉਸ ਵਿੱਚ ਕੂੜਾ ਫਸਿਆ ਹੈ ਸੋ ਸਾਨੂੰ ਜਿਵੇਂ ਕਿ ਦੋ ਕੁ ਹਫਤਿਆਂ ਬਾਅਦ ਸਾਨੂੰ ਇਹ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਜਿਸ ਨਾਲ ਇੱਕ ਤਾਂ ਗੈਸ ਬਚੇਗੀ ਅਤੇ ਖਾਣਾ ਬਣਾਉਂਦੇ ਵਕਤ ਸਾਨੂੰ ਕੋਈ ਖਤਰਾ ਨਹੀਂ ਹੋਵੇਗਾ ਤਾਂ ਇਹ ਗੱਲ ਦਾ ਹਮੇਸ਼ਾਂ ਖਿਆਲ ਰੱਖਣਾ ਚਾਹੀਦਾ ਹੈ ਧੰਨਵਾਦ